ਇੱਕੀ ਮਾਰਚ ਦੋ ਹਜ਼ਾਰ ਤਿੰਨ ਬਾਰਾਂ ਮਾਰਚ ਦੋ ਹਜ਼ਾਰ ਉੱਨੀ ਤੀਹ ਮਾਰਚ ਦੋ ਹਜ਼ਾਰ ਵੀਹ ਪੱਚੀ ਮਾਰਚ ਦੋ ਹਜ਼ਾਰ ਦੋ ਤਿੰਨ ਅਗਸਤ ਦੋ ਹਜ਼ਾਰ ਪੰਦਰਾਂ